ਮੈਨੂੰ ਸਭ ਤੋਂ ਜਿਆਦਾ ਖੂਬਸੂਰਤ ਪੰਛੀ ਮੋਰ ਲੱਗਦਾ ਹੈ ਮੇਰੇ ਸਭ ਤੋਂ ਮਨ ਪਸੰਦ ਪੰਛੀ ਹੈ ਮੋਰ ਜੋ ਕਿ ਸਾਡਾ ਨੈਸ਼ਨਲ ਪੱਕਸ਼ੀ ਵੀ ਮੋਰ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਆਪਣੀ ਕਿਤਾਬਾਂ ਵਿੱਚ ਦੇਖਦੀ ਹੁੰਦੀ ਸੀ ਕਿ ਮੋਰ ਬਹੁਤ ਸੋਹਣਾ ਹੈ ਫਿਰ ਮੈਂ ਆਪਣੇ ਘਰ ਦੇ ਕੋਲ ਇੱਕ ਪਾਰਕ ਚ ਗਈ ਜਿੱਥੇ ਮੈਂ ਮੋਰ ਨੂੰ ਹਕੀਕਤ ਵਿੱਚ ਦੇਖਿਆ ਤੇ ਜਦੋਂ ਮੈਂ ਹਕੀਕਤ ਵਿੱਚ ਦੇਖਿਆ ਮੈਂ ਉਹਨੂੰ ਦੇਖ ਕੇ ਬਹੁਤ ਖੁਸ਼ ਹੋਈ ਜੋ ਕੀ ਉਹ ਫੋਟੋ ਉਸ ਫੋਟੋ ਚੋਂ ਵੀ ਜਿਆਦਾ ਸੋਹਣਾ ਹਕੀਕਤ ਚ ਲੱਗਦਾ ਸੀ ਉਸ ਦੇ ਰੰਗ ਬਿਰੰਗ ਕਲਰ ਰੰਗ ਬਿਰੰਗ ਮੋਰ ਪੰਖੀ ਜੋ ਕਿ ਮੈਨੂੰ ਬਹੁਤ ਉਹਦੇ ਵੱਲ ਆਕਰਸ਼ਿਤ ਕਰਦੇ ਸਨ